ਹੈਲੋ ਗੁਡ ਮੋਰਨਿੰਗ ਮੈਮ ਮੈਮ ਮੈਂ ਛਾਇਆ ਬੋਲ ਰਹੀ ਹਾਂ ਤੁਹਾਡੀ ਸਟੂਡੈਂਟ ਮੈਮ ਐਕਚੁਲੀ ਮੇਰੀ ਅੰਡਰ ਗ੍ਰੈਜੂਏਸ਼ਨ ਕੋਰਸ ਕੰਪਲੀਟ ਹੋ ਚੁੱਕਿਆ ਅਤੇ ਮੈਂ ਹੁਣ ਯੂਨੀਵਰਸਿਟੀ ਐਡਮਿਸ਼ਨ ਲੈਣੀ ਸੀ ਅਤੇ ਮੈਮ ਮੇਰੇ ਸਬਜੈਕਟ ਪੋਲੀਟੀਕਲ ਜੌਗ੍ਰਾਫੀ ਅਤੇ ਲਿਟਰੇਚਰ ਆ ਤੁਹਾਨੂੰ ਪਤਾ ਹੀ ਆ ਕਿ ਮੇਰੇ ਇੰਟਰਸਟ ਕਿਵੇਂ ਦੇ ਰਹੇ ਨੇ ਅਤੇ ਮੈਮ ਮੈਂ ਪੁੱਛਣਾ ਸੀ ਅਤੇ ਤੁਹਾਡੇ ਤੋਂ ਗਾਈਡੈਂਸ ਲੈਣੀ ਸੀ ਕਿ ਮੈਂ ਇੰਨ ਫਿਊਚਰ ਇਹਨਾਂ ਵਿੱਚੋਂ ਕਿਹੜਾ ਸਬਜੈਕਟ ਪ੍ਰੈਫਰ ਕਰਾਂ ਅਤੇ ਮੈਂ ਕਿਹੜੇ ਵਿੱਚ ਅੱਗੇ ਮਾਸਟਰ ਕਰਾਂ ਹਾਂਜੀ ਹਾਂਜੀ ਮੈਮ ਮੈਂ ਸੋਚਿਆ ਸੀ ਕਿ ਮੈਂ ਜੌਗ੍ਰਾਫੀ ਦੇ ਵਿੱਚ ਐੱਮਐੱਸਈ ਕਰਾਂ ਅਤੇ ਉਹ ਤੋਂ ਬਾਅਦ ਮੈਂ ਨੈਟ ਦੇ ਪੇਪਰ ਕਲੀਅਰ ਕਰ ਦਾਂ ਓਕੇ ਮੈਮ ਮੈਮ ਮੈਂ ਪੁੱਛਣਾ ਸੀ ਇਹਦੀ ਰਿਕੁਆਇਰਮੈਂਟ ਕੀ ਕੀ ਕੁਆਲੀਫਿਕੇਸ਼ਨ ਹੁੰਦੀਆਂ ਨੇ ਓਕੇ ਮੈਮ ਥੈਂਕ ਯੂ ਸੋ ਮਚ ਮੈਮ ਠੀਕ ਹੈ ਮੈਮ ਥੈਂਕ ਯੂ ਸੋ ਮਚ ਮੈਮ